ਜਦੋਂ ਲੋਕਡਾਊਨ ਲੱਗਿਆ ਹੋਇਆ ਸੀ ਤਾਂ ਮੇਰੇ ਸੀਨੀਅਰ ਬਾਹਰ ਰਹਿੰਦੇ ਸੀ ਤਾਂ ਜਿਸ ਕਰਕੇ ਮੈਨੂੰ ਕੰਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਤਾਂ ਜੋ ਵੀ ਕੰਮ ਹੁੰਦਾ ਸੀ ਤਾਂ ਮੇਰੇ ਸੀਨੀਅਰ ਮੈਨੂੰ ਮੇਲ 'ਤੇ ਹੀ ਦੱਸਦੇ ਸੀ ਤਾਂ ਫਿਰ ਉਹਨਾਂ ਨੂੰ ਮੈਂ ਮੇਲ ਕੀਤੀ ਕਿ ਮੈਨੂੰ ਕੋਈ ਇੱਦਾਂ ਦਾ ਕਾਨਟੈਕਟ ਦਿੱਤਾ ਜਾਵੇ ਜਿਸ ਰਾਹੀਂ ਮੈਂ ਤੁਹਾਡਾ ਵੀਡੀਉ ਕਾਲ 'ਤੇ ਜੋ ਵੀ ਮੁਸ਼ਕਿਲ ਆ ਰਹੀ ਹੈ ਤਾਂ ਮੈਂ ਉਸਦਾ ਹੱਲ ਕੱਢ ਸਕੀਏ ਰਲ ਕੇ ਤਾਂ ਸੀਨੀਅਰ ਨੇ ਮੈਨੂੰ ਨੰਬਰ ਦਿੱਤਾ ਤਾਂ ਉਹਨਾਂ ਨਾਲ ਵੀਡੀਉ ਕਾਲ 'ਤੇ ਗੱਲ ਹੁੰਦੀ ਸੀ ਤਾਂ ਉਹਨਾਂ ਨੂੰ ਆਪਣੇ ਹਰ ਇੱਕ ਪਰੇਸ਼ਾਨੀ ਦੱਸ ਰਿਹਾ ਸੀ ਤਾਂ ਉਹਨਾਂ ਦੇ ਨਾਲ ਰਲ ਕੇ ਸੋਲਵ ਕੀਤੀ ਇਸੇ ਤਰ੍ਹਾਂ ਲੰਮੇ ਸਮੇਂ ਤੱਕ ਚੱਲਦਾ ਰਿਹਾ ਹੌਲੀ ਹੌਲੀ ਜੋ ਦਿੱਕਤ ਆ ਰਹੀ ਸੀ ਤਾਂ ਉਹ ਸੋਲਵ ਹੋ ਗਈ ਤਾਂ ਜਿਸ ਤਰ੍ਹਾਂ ਆਪਣੇ ਬੋਸ ਨੂੰ ਮਿਲ ਤਾਂ ਨਹੀਂ ਸਕਦਾ ਸੀ ਫਿਰ ਉਹਨਾਂ ਨਾਲ ਵੀਡੀਉ ਕਾਲ 'ਤੇ ਹੀ ਸਾਰਾ ਕੁਛ ਰਲ ਕੇ ਉਹਨਾਂ ਨਾਲ ਉਹਨਾਂ ਨੂੰ ਸਾਰੀ ਆਪਣੀ ਪ੍ਰੋਬਲਮ ਦੱਸ ਕੇ ਤਾਂ ਉਸਨੂੰ ਸੋਲਵ ਕੀਤਾ ਤਾਂ ਇਸ ਤਰ੍ਹਾਂ ਕੰਮ ਕਰਦਾ ਰਿਹਾ ਲੋਕਡਾਊਨ ਦੇ ਵਿੱਚ ਬਹੁਤ ਜਿਆਦਾ ਪਰੇਸ਼ਾਨੀ ਆ ਰਹੀ ਸੀ ਤਾਂ ਵੀਡੀਉ ਕਾਲ ਰਾਹੀਂ ਕੰਮ ਕਰਨਾ ਥੋੜ੍ਹਾ ਜਿਹਾ ਆਸਾਨ ਹੋ ਗਿਆ ਸੀ